ਤੀਹ ਜੂਨ ਦੋ ਹਜ਼ਾਰ ਪੰਦਰ੍ਹਾਂ ਅਗਸਤ ਉੱਨੀ ਸੌ ਸੰਨਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਪੰਦਰ੍ਹਾਂ ਜੁਲਾਈ ਉਨ ਉੱਨੀ ਸੌ ਸਤੱਤਰ ਅਤੇ ਛੇ ਜੁਲਾਈ ਦੋ ਹਜ਼ਾਰ ਤਿੰਨ